ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਜੈ ਡੋਕਟਰ ਜੈਸਮੀਨ ਬੋਲ ਰਹੀ ਹਾਂ ਠੀਕ ਹੈ ਅਤੇ ਤੁਹਾਡਾ ਇਹ ਦਰਦ ਕਿੰਨਾ ਕੁ ਪੁਰਾਣਾ ਹੈ

ਅੱਛਾ ਅਤੇ ਇਹ ਦਰਦ ਜਿਹੜਾ ਇਕੱਲਾ ਗਰਦਨ 'ਚ ਹੀ ਰਹਿੰਦਾ ਹੈ ਜਾਂ ਨੀਚੇ ਬਾਹਾਂ ਤੱਕ ਵੀ ਜਾਂਦਾ ਹੱਥ ਹੱਥ ਤਾਂ ਨਹੀਂ ਸੁੰਨ ਹੁੰਦੇ ਠੀਕ ਹੈ ਅਤੇ ਜਦੋਂ ਤੁਹਾਡੀਆਂ ਸਟਡੀਜ਼ ਦਾ ਟਾਈਮ ਹੁੰਦਾ ਪੜ੍ਹਨ ਦਾ ਜਾਂ ਹੈ ਨਾ ਤੁਸੀਂ ਆਪਦੇ ਪੇਪਰਾਂ ਦੀ ਤਿਆਰੀ ਕਰਦੇ ਹੋ ਅਤੇ ਤਦ ਜਿਹੜਾ ਤੁਹਾਡਾ ਪੋਸਚਰ ਹੁੰਦਾ ਬੋਡੀ ਦਾ ਉਹ ਜ਼ਿਆਦਾ ਝੁਕ ਕੇ ਝੁਕਿਆ ਵਾ ਹੁੰਦਾ ਮਤਲਬ ਤੁਸੀਂ ਕੁੱਬ ਪਾ ਕੇ ਰੱਖਦੇ ਓਕ ਗੈਜੇਟਸ ਜ਼ਿਆਦਾ ਯੂਜ ਕਰਦੇ ਹੋ ਸਟਡੀ ਟਾਈਮ ਠੀਕ ਹੈ ਤੁਹਾਡੇ ਨਾ ਆਹਾ ਇਹਨੂੰ ਆਪਾਂ ਮੈਡੀਕਲ ਟਰਮਸ 'ਚ ਕਹਿ ਦਿੰਦੇ ਹੈ ਮਕੈਨੀਕਲ ਨੈੱਕ ਪੇਨ ਅਤੇ ਇਹਦੇ ਬਹੁਤ ਸਾਰੇ ਕਾਰਨ ਹੁੰਦੇ ਪਹਿਲਾਂ ਕਾਰਨ ਤਾਂ ਤੁਹਾਡਾ ਪੂਅਰ ਪੋਸਚਰ ਹੁੰਦਾ ਖਰਾਬ ਪੋਸਚਰ ਠੀਕ ਕਿਉਂਕਿ ਜਦੋਂ ਆਪਾਂ ਪੜ੍ਹਨਾ ਹੁੰਦਾ ਜਾਂ ਆਪਾਂ ਫੋਨ ਵਗੈਰਾ ਜਾਂ ਲੈਪਟੋੇਪ ਕੁਛ ਵੀ ਯੂਜ ਕਰਦੇ ਹਾਂ ਹੈ ਨਾ ਤਾਂ ਉਹਦੇ ਨਾਲ ਕੀ ਹੁੰਦਾ ਕਿ ਆਪਣਾ ਫੋਰਵਰਡ ਹ ਨੈਕ ਪੋਸਚਰ ਹੋ ਜਾਂਦਾ ਮਤਲਬ ਗਰਦਨ ਹੈ ਜੋ ਆਪਣੀ ਢੂਹੀਂ ਨਾਲੋਂ ਨਾ ਆਪਾਂ ਗਰਦਨ ਥੋੜ੍ਹੀ ਜਿਹੀ ਅੱਗੇ ਜਿਹੇ ਰੱਖਣੀ ਸਟਾਰਟ ਕਰ ਦਿੰਦੇ ਹਾਂ ਤਾਂ ਉਹਦੇ ਨਾਲ ਖਿਚਾਉ ਪੈਂਦਾ ਆਪਣੇ ਪਿਛਲੀਆਂ ਮਤਲਬ ਪਿਛਲੇ ਗਰਦਨ ਵਾਲੀ ਸਾਈਡ ਅਤੇ ਇਹ ਇੱਕ ਰੀ ਰੀਜ਼ਨ ਇਹ ਹੋ ਗਿਆ ਅਤੇ ਦੂਜਾ ਵੀ ਆਪਣੇ ਨਾ ਟਰਿਗਰ ਪੁਆਇੰਟਸ ਬਣ ਜਾਂਦੇ ਹੁੰਦੇ ਹੈ ਜਦੋਂ ਆਪਾਂ ਨੂੰ ਕੋਈ ਵੀ ਟੈਂਸ਼ਨ ਹੁੰਦੀ ਹੈ ਨਾ ਜਾਂ ਆਪਾਂ ਨੂੰ ਐਂ ਹੁੰਦਾ ਵੀ ਆਪਣੇ ਪੇਪਰ ਹੈ ਕੋਈ ਵੀ ਚੀਜ਼ ਆ ਤਾਂ ਉਹਦੇ ਨਾਲ ਨਾ ਇੱਕ ਤਾਂ ਆਪਣੇ ਜਿਹੜਾ ਫੇਸੀਆ ਹੁੰਦਾ ਬੋਡੀ ਦਾ ਉਹਦੇ ਵਿੱਚ ਨਾ ਡਿਫਰੈਪਸ਼ਨ ਸਟਾਰਟ ਹੋ ਜਾਂਦੀ ਹੈ ਤਾਂ ਉਹ ਟਰੀਗਰ ਪੁਆਇੰਟਸ ਬਣਾ ਦਿੰਦਾ ਅਤੇ ਦੂਜਾ ਜਦੋਂ ਆਪਾਂ ਪਾਣੀ ਵਗੈਰਾ ਘੱਟ ਪੀਂਦੇ ਹਾਂ ਹੈ ਨਾ ਤਾਂ ਉਹਦੇ ਨਾਲ ਵੀ ਡੀਹਾਈਡਰੇਸ਼ਨ ਹੋਣ ਕਾਰਨ ਵੀ ਜਿਹੜਾ ਆਪਣਾ ਮਸਲ ਆ ਉਹਦੇ 'ਚ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਗੱਠਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਉਹ ਚੀਜ਼ ਵੀ ਦਰਦ ਦਾ ਕਾਰਨ ਹੈ ਤੁਹਾਡੇ ਟਰੀਗਰ ਪੁਆਇੰਟਸ ਆ ਸਿੰਪਲ ਮਕੈਨੀਕਲ ਨੈਕ ਪੇਨ ਹੈ ਇਹਦਾ ਜਿਹੜਾ ਟਰੀਟਮੈਂਟ ਹੈ ਉਹ ਮੋਸਟਲੀ ਪੰਜ ਜਾਂ ਛੇ ਸਿਟਿੰਗਸ ਦੀ ਲੋੜ ਹੈ ਉਸ ਤੋਂ ਬਾਅਦ ਤੁਸੀਂ ਬਿਲਕੁਲ ਸਹੀ ਹੋ ਜੋਗੇ ਕੁਛ ਤੁਹਾਨੂੰ ਰੈਗੂਲਰ ਘਰ ਐਕਸਰਸਾਈਜ ਕਰਨ ਦੀ ਲੋੜ ਹੈ ਹਾਂਜੀ ਹਾਂਜੀ ਜ਼ਰੂਰ ਸਤਿ ਸ਼੍ਰੀ ਅਕਾਲ